ਮੈਨੂੰ ਪੰਛੀ ਬਹੁਤ ਪਸੰਦ ਨੇ ਮੈਨੂੰ ਪੰਛੀਆਂ ਨੂੰ ਦਾਣਾ ਪਾਣਾ ਪੰਛੀਆਂ ਨੂੰ ਪਾਣੀ ਰੱਖਣਾ ਬਹੁਤ ਅੱਛਾ ਲੱਗਦਾ ਹੈ ਮੈਂ ਆਪਣੇ ਕੋਠੇ 'ਤੇ ਵੀ ਪੰਛੀਆਂ ਵਾਸਤੇ ਦਾਣਾ ਅਤੇ ਪਾਣੀ ਰੱਖਿਆ ਹੋਇਆ ਹੈ ਮੈਨੂੰ ਪੰਛੀ ਜਿਹੜੇ ਵੀ ਪੰਛੀ ਨੂੰ ਮੈਂ ਦੇਖਦੀ ਹਾਂ ਮੈਨੂੰ ਉਹਨੂੰ ਦੇਖ ਕੇ ਬਹੁਤ ਅੱਛਾ ਲੱਗਦਾ ਹੈ ਅਤੇ ਜੇ ਮੈਂ ਕੋਈ ਵੱਖਰੇ ਟਾਈਪ ਦਾ ਪੰਛੀ ਦੇਖਦੀ ਹਾਂ ਅਤੇ ਮੈਂ ਉਹਦੀ ਫੋਟੋ ਖਿੱਚ ਲੈਂਦੀ ਹਾਂ ਫੋਟੋ ਖਿੱਚ ਲੈਂਦੀ ਹਾਂ ਫੋਟੋ ਖਿੱਚ ਕੇ ਮੈਂ ਐਪ 'ਤੇ ਪਾ ਕੇ ਅਤੇ ਉਹਦੀ ਉਹਦੇ ਬਾਰੇ ਜਾਣਕਾਰੀ ਲੈਂਦੀ ਹਾਂ ਮੈਂ ਦੇਖਦੀ ਹਾਂ ਕਿ ਇਸ ਪੰਛੀ ਦਾ ਸੁਭਾਵ ਕਿੱਦਾਂ ਦਾ ਹੈ ਇਹ ਪੰਛੀ ਕਿਹੜਾ ਹੈ ਅਤੇ ਮੈਂ ਉਸਦੇ ਬਾਰੇ ਜਾਣਕਾਰੀ ਲੈਂਦੀ ਹਾਂ ਜੇਕਰ ਮੈਂ ਕਿਸੇ ਟਾਈਮ ਚਿੜੀਆ ਘਰ ਜਾਦੀ ਹਾਂ ਅਤੇ ਉੱਥੇ ਵੱਖ ਵੱਖ ਪੰਛੀਆਂ ਦੇ ਨੂੰ ਦੇਖ ਕੇ ਮੈਂ ਉਹਨਾਂ ਬਾਰੇ ਜਾਣਕਾਰੀ ਲੈਂਦੀ ਹਾਂ ਅਤੇ ਉਹਨਾਂ ਦੇ ਨਾਮ ਪੜ੍ਹ ਲੈਂਦੀ ਹਾਂ ਨਾਮ ਪੜ੍ਹ ਕੇ ਅਤੇ ਮੈਂ ਐਪ 'ਤੇ ਉਹਨਾਂ ਦੇ ਨਾਮ ਪਾ ਕੇ ਉਹਨਾਂ ਦੇ ਬਾਰੇ 'ਚ ਉਹਨਾਂ ਦੇ ਖਾਣ ਪੀਣ ਦੇ ਬਾਰੇ 'ਚ ਉਹਨਾਂ ਦੇ ਸੁਭਾਵ ਦੇ ਬਾਰੇ 'ਚ ਅਤੇ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਵ ਹੈਗਾ ਅਤੇ ਉਹ ਕੀ ਖਾਂਦੇ ਨੇ ਉਹਦੇ ਬਾਰੇ 'ਚ ਮੈਂ ਜਾਣਕਾਰੀ ਲੈਂਦੀ ਹਾਂ ਪੰਛੀਆਂ ਨੂੰ ਦਾਣਾ ਪਾਣਾ ਇੱਕ ਬਹੁਤ ਅੱਛਾ ਕੰਮ ਹੈ ਕਿਉਂਕਿ ਜਦੋਂ ਵੀ ਅਸੀਂ ਕਿਸੇ ਪੰਛੀ ਨੂੰ ਦਾਣਾ ਪਾਂਦੇ ਹਾਂ ਪਾਣੀ ਰੱਖਣੇ ਹਾਂ ਜਦੋਂ ਉਹ ਪੰਛੀ ਆ ਕੇ ਦਾਣਾ ਅਤੇ ਪਾਣੀ ਖਾਣ ਲੱਗਦੇ ਹਾਂ ਅਤੇ ਆਪਣੇ ਦਿਲ ਨੂੰ ਇੱਕ ਤਸੱਲੀ ਜਿਹੀ ਹੁੰਦੀ ਹੈ ਕਿ ਅਸੀਂ ਪੰਛੀਆਂ ਨੂੰ ਦਾਣਾ ਪਾਇਆ ਹੈ ਅਤੇ ਪੰਛੀ ਦਾਣਾ ਖਾ ਰਹੇ ਹਨ ਅਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਪੰਛੀਆਂ ਨੂੰ ਹਮੇਸ਼ਾ ਦਾਣਾ ਪਾਣਾ ਚਾਹੀਦਾ ਅਤੇ ਪੰਛੀਆਂ ਨੂੰ ਅਗਰ ਕੁਝ ਪ੍ਰੋਬਲਮ ਆ ਰਹੀ ਹੈ ਅਤੇ ਉਹਨਾਂ ਦੀ ਰਕਸ਼ਾ ਵੀ ਕਰਨੀ ਚਾਹੀਦੀ ਕਿਸੀ ਟਾਈਮ ਕੋਈ ਪੰਛੀ ਜ਼ਖਮੀ ਹੋ ਜਾਂਦਾ ਹੈ ਅਤੇ ਉਹਦੀ ਵੀ ਰਕਸ਼ਾ ਕਰਨੀ ਚਾਹੀਦੀ ਹੈ